ਹਾਂ ਮੈਂ ਇੱਕ ਧਾਰਮਿਕ ਮੌਕੇ ਲਈ ਦੇਵਤਿਆਂ ਦੀ ਮੂਰਤੀ ਬਣਾਈ ਸੀ ਉ ਮੈਂ ਸ਼੍ਰੀ ਗਣੇਸ਼ ਜੀ ਦੀ ਮੂਰਤੀ ਬਣਾਈ ਸੀ ਜਦੋਂ ਸ਼੍ਰੀ ਗਣੇਸ਼ ਜੀ ਦਾ ਉਤਸਵ ਹੁੰਦਾ ਹੈ ਇਹ ਮੁੰਬਈ ਵਿੱਚ ਬਹੁਤ ਹੀ ਧੂਮਧਾਮ ਨਾਲ ਮਨਾਇਆ ਜਾਂਦਾ ਹੈ ਪਰ ਹੁਣ ਇਹ ਪੂਰੇ ਭਾਰਤ ਵਿੱਚ ਹੀ ਬੜੇ ਧੂਮਧਾਮ ਨਾਲ ਮਨਾਇਆ ਜਾਣ ਲੱਗ ਪਿਆ ਹੈ ਉਸ ਦੀ ਵਜ੍ਹਾ ਇਹ ਹੈ ਕਿ ਸ਼੍ਰੀ ਗਣੇਸ਼ ਜੀ ਹਿੰਦੂਆਂ ਦੇ ਵਿੱਚ ਸਭ ਤੋਂ ਉੱਪਰ ਮੰਨੇ ਜਾਂਦੇ ਹਨ ਅਤੇ ਉਹਨਾਂ ਦੀ ਪੂਜਾ ਵੀ ਸਭ ਨਾਲੋਂ ਪਹਿਲਾਂ ਹੀ ਕੀਤੀ ਜਾਂਦੀ ਹੈ ਸ਼ ਸ਼੍ਰੀ ਭਗਵਾਨ ਸ਼ਿਵ ਜੀ ਨੇ ਉਹਨਾਂ ਨੂੰ ਆਸ਼ੀਰਵਾਦ ਦਿੱਤਾ ਸੀ ਕਿ ਸਭ ਨਾਲੋਂ ਪਹਿਲਾਂ ਜਿਹੜਾ ਵੀ ਕੰਮ ਸ਼ੁਭ ਹੋਵੇਗਾ ਉਹਨਾਂ ਦੀ ਹੀ ਪੂਜਾ ਕੀਤੀ ਜਾਵੇਗੀ ਇਸ ਕਰਕੇ ਉਹਨਾਂ ਦੀ ਪੂਜਾ ਸਭ ਤੋਂ ਜ਼ਿਆਦਾ ਕੀਤੀ ਜਾਂਦੀ ਹੈ ਲੋਕ ਉਹਨਾਂ ਦੀ ਪੂਜਾ ਉਹਨਾਂ ਦਿਨਾਂ ਵਿੱਚ ਚੌਦਾਂ ਦਿਨ ਲਈ ਬਾਰਾਂ ਦਿਨ ਲਈ ਜਾਂ ਦਸ ਦਿਨ ਲਈ ਵੀ ਕਰਦੇ ਹਨ ਕਈ ਤਾਂ ਇੱਕ ਦਿਨ ਵੀ ਲਈ ਵੀ ਲਿਆਉਂਦੇ ਹਨ ਅਤੇ ਮੈਂ ਉਹਨਾਂ ਦਿਨਾਂ ਵਿੱਚ ਇੱਕ ਦਿਨ ਲਈ ਲਿਆਂਦੇ ਸੀ ਜਿਹਦੇ ਵਿੱਚ ਮੈਂ ਉਹਨਾਂ ਦੀ ਮੂਰਤੀ ਮਿੱਟੀ ਦੇ ਨਾਲ ਬਣਾਈ ਸੀ ਮੈਨੂੰ ਉਹ ਬਣਾਉਣ ਦੇ ਵਿੱਚ ਪੂਰਾ ਇੱਕ ਦਿਨ ਲੱਗ ਗਿਆ ਸੀ ਕਿਉਂਕਿ ਅਗਲੇ ਦਿਨ ਹੀ ਉਹਨਾਂ ਦੀ ਮੂਰਤੀ ਦੀ ਸਥਾਪਨਾ ਕਰਨੀ ਸੀ ਇਸ ਕਰਕੇ ਮੈਨੂੰ ਉਹ ਦਿਨ ਹਜੇ ਤੱਕ ਨਹੀਂ ਭੁੱਲਦਾ ਮੈਂ ਉਸ ਦਿਨ ਬਹੁਤ ਹੀ ਆਨੰਦ ਮਾਣਦਾ ਹਾਂ ਕਿ ਜਿੱਦਣ ਮੈਂ ਉਹ ਮੂਰਤੀ ਬਣਾਈ ਸੀ ਉਸ ਮੌ ਧਾਰਮਿਕ ਮੌਕੇ 'ਤੇ ਮੈਂ ਸ਼੍ਰੀ ਗਣੇਸ਼ ਜੀ ਨੂੰ ਬਹੁਤ ਹੀ ਮੰਨਦਾ ਹਾਂ ਉਹ ਧਾਰਮਿਕ ਮੌਕਾ ਮੇਰੇ ਲਈ ਬਹੁਤ ਹੀ ਵਧੀਆ ਸੀ ਅਤੇ ਮੈਂ ਉਹ ਮੂਰਤੀ ਨੂੰ ਮਿੱਟੀ ਨਾਲ ਆਪਣੇ ਹੱਥਾਂ ਨਾਲ ਬਣਾਇਆ ਸੀ ਉਹ ਮਿੱਟੀ ਦੀ ਮੂਰਤੀ ਮੇਰੇ ਲਈ ਬਹੁਤ ਹੀ ਮਾਨਿਆ ਮਾਨਿਅਤਾ ਰੱਖਣੀ ਸੀ ਇਸ ਲਈ ਕਿਉਂਕਿ ਮੈਨੂੰ ਸ਼੍ਰੀ ਗਣੇਸ਼ ਜੀ ਨਾਲ ਬਹੁਤ ਹੀ ਪਿਆਰ ਸੀ ਧੰਨਵਾਦ